ਹਾਂ ਅਗਰ ਗੱਲ ਕਰੀਏ ਬਾਈਕਿੰਗ ਕਮਿਊਨਿਟੀ ਦੀ ਇਸ ਮੈਨੂੰ ਇਸ ਤਾਂ ਕਰਕੇ ਇਸ ਤਰ੍ਹਾਂ ਮੈਨੂੰ ਪਸੰਦ ਕਿਉਂਕਿ ਇਸ ਨੂੰ ਅਸੀਂ ਜਿੱਥੇ ਮਰਜ਼ੀ ਲਿਜਾ ਸਕਦੇ ਹਾਂ ਚਾਹੇ ਤੰਗ ਬਾਜ਼ਾਰ ਹੋਵੇ ਜਾਂ ਭੀੜੀਆਂ ਗਲੀਆਂ ਹੋਣ ਪਰ ਇਸੇ ਦੌਰਾਨ ਮੈਨੂੰ ਇਹ ਇਕੱਲਾ ਚਲਾਉਣ ਬਾਈਕ ਦੇ ਮੈਨੂੰ ਇਹ ਇਕੱਲਾ ਚਲਾਉਣਾ ਮੈਨੂੰ ਜ਼ਿਆਦਾ ਪਸੰਦ ਹੈ ਪਰਿਵਾਰ ਨੂੰ ਮੈਂ ਹਮੇਸ਼ਾ ਗੱਡੀ ਦੇ ਵਿੱਚ ਹੀ ਲੈ ਕੇ ਜਾਂਦਾ ਹਾਂ ਕਿਉਂਕਿ ਉਹ ਜਿਵੇਂ ਮੇਰਾ ਬੱਚੇ ਹੋ ਗਏ ਫੈਮਲੀ ਹੋ ਗਏ ਉਹ ਗੱਡੀ ਵਿਚ ਜਾਂਦੇ ਅਗਰ ਮੈਂ ਇਕੱਲਾ ਜਾਣਾ ਹੋਵੇ ਕਿਤੇ ਵੀ ਤਾਂ ਮੈਂ ਹਮੇਸ਼ਾ ਬਾਈਕ 'ਤੇ ਹੀ ਜਾਣਾ ਪਸੰਦ ਕਰਦਾ ਹਾਂ ਕਿਉਂਕਿ ਇਸਦੇ ਇਸ ਨੂੰ ਕਿਤੇ ਵੀ ਪਾਰਕ ਕਰ ਸਕਦੇ ਹਾਂ ਆਪਾਂ ਕਿਤੇ ਵੀ ਲਿਜਾ ਸਕਦੇ ਹਾਂ ਤੰਗ ਜਗ੍ਹਾ ਦੇ ਵਿੱਚ ਨੂੰ ਵੀ ਇਹ ਨਿਕਲ ਜਾਂਦਾ ਹੈ ਔਰ ਇਸਨੂੰ ਕਿਤੇ ਵੀ ਖੜ੍ਹਾ ਸਕਦੇ ਹਾਂ ਅਰ ਸਾਨੂੰ ਮੈਨੂੰ ਇਸ ਕਰਕੇ ਵੀ ਪਸੰਦ ਹੈ ਕਿਉਂਕਿ ਇਹ ਇੱਕ ਤਾਂ ਇਸਦੀ ਤੇਲ ਦੀ ਐਵਰੇਜ ਜੋ ਕਿ ਤੇਲ ਦੀ ਮਾਇਲਜ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਆਮ ਦੂਸਰੇ ਗੱਡੀਆਂ ਨਾਲੋਂ ਅਤੇ ਇਹ ਵੈਸੇ ਵੀ ਆਪਾਂ ਨੂੰ ਜੇ ਕਿਤੇ ਵੀ ਮੈਂ ਇਹ ਸਲਾ ਜੇ ਕਿਸੇ ਨੇ ਇਕੱਲੇ ਬੰਦੇ ਨੇ ਵੀ ਜਾਣਾ ਹੋਵੇ ਤਾਂ ਉਹ ਹਮੇਸ਼ਾ ਉਸਨੂੰ ਬਾਇਕ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਇੱਕ ਤਾਂ ਟਰੈਫਿਕ ਦੇ ਵਿੱਚ ਥੋੜ੍ਹਾ ਜਿਹਾ ਸਹੂਲਤ ਮਿਲਦੀ ਹੈ ਉੱਥੇ ਹੀ ਪੋਲਿਊਸ਼ਨ ਦੇ ਵਿੱਚ ਵੀ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਸ਼ਾਇਦ ਨਾ ਕਿਤੇ ਨਾ ਕਿਤੇ ਇਹ ਫਾਇਦੇਮੰਦ ਹੁੰਦੀ ਹੋਵੇ